ਹੈਲੋ ਫਲਿੱਪਕਾਰਟ ਮੈਂ ਤੁਹਾਡੇ ਤੋਂ ਇੱਕ ਏ ਸੀ ਬਾਏ ਕੀਤਾ ਸੀ ਜੋ ਕਿ ਪਹਿਲਾਂ ਪਹਿਲਾਂ ਇੱਕ ਹਫਤਾ ਬਹੁਤ ਵਧੀਆ ਚੱਲਿਆ ਵੱਟ ਹੁਣ ਕੂਲਿੰਗ ਬਹੁਤ ਘੱਟ ਕਰ ਰਿਹਾ ਹੈ ਅਤੇ ਜੋ ਉਹਦੀ ਚੱਲਣੇ ਦੀ ਅਵਾਜ਼ ਹੈ ਉਹ ਬਹੁਤ ਜ਼ਿਆਦਾ ਵੱਧ ਗਈ ਹੈ ਮੈਨੂੰ ਲੱਗਦਾ ਹੈ ਕਿ ਮੈਂ ਇਸ 'ਤੇ ਆਪਣੇ ਪੈਸੇ ਹੀ ਵੇਸਟ ਕੀਤੇ ਨੇ